ਆਮ ਤੌਰ ਪਰ ਤੁਸੀਂ ਦੁਪਹਿਰ ਅਤੇ ਰਾਤ ਦੇ ਖਾਣੇ ਵਿੱਚ ਕੀ ਪਕਾਉਂਦੇ ਹਨ ਅਸੀਂ ਦੁਪਹਿਰ ਦੇ ਖਾਣੇ ਵਿੱਚ ਤਾਂ ਕੜੀ ਚੌਲ ਹੋ ਗਏ ਅਤੇ ਕੜੀ ਚੌਲ ਬਣਾਉਣੇ ਬਣਾਉਂਦੇ ਹਾਂ ਅਤੇ ਉਸ ਤੋਂ ਬਾਅਦ ਅਸੀਂ ਆਪਣਾ ਅਤੇ ਸ਼ਾਮ ਨੂੰ ਅਸੀਂ ਆਪਣਾ ਠੇ ਠੇਕੇ ਚਲੇ ਜਾਂਦੇ ਠੇਕੇ ਦੇ ਵਿੱਚ ਜਾ ਕੇ ਬੋਤਲ ਲਿਆਉਂਦਾ ਬੋਤਲ ਦੇ ਬਾਅਦ ਅਸੀਂ ਇੱਥੇ ਰਸਤੇ ਦੇ ਵਿੱਚ ਕੋਈ ਉਹਦੇ ਵਾਲਾ ਹੁੰਦਾ ਹੈ ਇਹ ਮੁਰਗੇ ਵਾਲ਼ਾ ਅਤੇ ਅਸੀਂ ਆਪਣਾ ਮੁਰਗਾ ਸਾ ਅ ਮੁਰਗਾ ਕਟਵਾ ਕੁਟਵਾ ਕੇ ਉੱਥੇ ਅਤੇ ਅਤੇ ਅਸੀਂ ਆਪਣਾ ਘ ਘਰ ਨੂੰ ਆ ਜਾਂਦੇ ਹਾਂ ਘਰ 'ਤੇ ਆ ਕਰ ਉਹਨੂੰ ਧੋ ਧੂ ਕੇ ਉਹਨੂੰ ਚੁੱ ਚੁ੍ਲ੍ਹੇ ਉੱਪਰ ਬਣਾ ਕੇ ਅਸੀਂ ਆਪਣਾ ਸ਼ਾਮ ਨੂੰ ਉਹਦੇ ਵਿੱਚ ਯਾਰ ਦੋਸਤ ਆ ਜਾਂਦੇ ਨੇ ਸਾਰੇ ਇਕੱਠੇ ਹੋ ਕੇ ਆਪਣਾ ਨਾਲੇ ਪੈੱਗ ਸ਼ੈੱਗ ਲਾਈਦਾ ਨਾਲੇ ਉਸ ਦੇ ਵਿੱਚ ਉਹ ਤੋਂ ਬਾਅਦ ਆਪਣਾ ਅਤੇ ਆਪਣਾ ਇੰਨਜ ਇੰਨਜੋਏ ਕਰੀ ਜਾਈਦਾ ਅਤੇ ਕ ਦੁਪਹਿਰ ਨੂੰ ਆਪਣਾ ਉਹਦਾ ਇੱਕ ਤਾਂ ਰੋ ਦੂਜੀ ਰੋਟੀ ਬਣਾਉਣੀ ਆ ਅਸੀਂ ਆਪਣੀ ਉਹਦੇ ਤੰਦੂਰੀ ਰੋਟੀ ਬਣਾਉਣੀ ਕਿਤੇ ਤੰਦੂਰੀ ਰੋਟੀ ਦੇ ਨਾਲ ਮੁਰ ਮੁਰਗਾ ਅਤੇ ਚੌਲ਼ ਹੋ ਗਏ ਅਤੇ ਇਸ ਤੋਂ ਬਾਅਦ ਅਸੀਂ ਸ਼ਾਮ ਨੂੰ ਆਪਣਾ ਸਲਾਦ ਸਲੂਦ ਕੱਟ ਕੇ ਆਪਣਾ ਪੂਰਾ ਇੰਨਜੋਏ ਕਰੀਦਾ ਜਾਣੀ ਕਹਿਣ ਦਾ ਮਤਲਬ ਆ